ਪੰਜਾਬ ਵਿੱਚ ਕਈ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਕਈ ਲੋਕ ਹੱਥਾਂ ਨਾਲ ਪੇਪਰਾਂ 'ਤੇ ਚਿੱਤਰਕਾਰੀ ਕਰਦੇ ਹਨ ਅਤੇ ਕਈ ਪੱਥਰਾਂ 'ਤੇ ਜਾਂ ਕੰਧਾਂ 'ਤੇ ਮੈਂ ਜਿਸ ਚੀਜ਼ ਬਾਰੇ ਗੱਲ ਕਰਨ ਜਾ ਰਹੀ ਹਾਂ ਉਹ ਹੈ ਪੱਥਰਾਂ ਦੀ ਚਿੱਤਰਕਾਰੀ ਮੈਂ ਇਸ ਦੀਆਂ ਕਲਾਸਾਂ ਵੀ ਲਗਾਈਆਂ ਹਨ ਜੋ ਕਿ ਲਗਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਂ ਇਸ ਵਿੱਚ ਗੱਲ ਕਰ ਰਹੀ ਹਾਂ ਪੱਥਰਾਂ ਦੀ ਚਿੱਤਰਕਾਰੀ ਦੀ ਜਿਸ ਨੂੰ ਅਸੀਂ ਰੋਕ ਆਟ ਵੀ ਕਹਿੰਦੇ ਹਾਂ ਪੱਥਰਾਂ 'ਤੇ ਕੀਤੀ ਚਿੱਤਰਕਾਰੀ ਬਹੁਤ ਹੀ ਸੋਹਣੀ ਅਤੇ ਖੁਸ਼ਮਈ ਲੱਗਦੀ ਹੈ ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਅਤੇ ਲੋਕ ਬਹੁਤ ਹੀ ਦੇਖਣ ਆਉਂਦੇ ਹਨ ਇਸ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਇਸ ਦੀ ਇੱਕ ਬਹੁਤ ਹੀ ਮਜ਼ੇਦਾਰ ਉਦਾਹਰਨ ਹੈ ਜੋ ਕਿ ਰੋਕ ਗਾਰਡਨ ਚੰਡੀਗੜ੍ਹ ਜਿਸ 'ਤੇ ਸਾਰੀ ਕਲਾਕਾਰੀ ਚਿੱਤਰਕਾਰੀ ਪੱਥਰਾਂ ਉੱਤੇ ਹੀ ਕੀਤੀ ਗਈ ਹੈ ਪੱਥਰਾਂ ਦੇ ਹਾਥੀ ਪੱਥਰਾਂ ਦੀ ਗੁਫਾ ਪੱਥਰਾਂ ਦੇ ਝੰਨੇ ਅਤੇ ਪੱਥਰਾਂ ਦੀਆਂ ਪੋੜੀਆਂ ਜੋ ਕਿ ਦੇਖਣ ਦਾ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਜਿਸ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹੁੰਦੇ ਹਨ ਅਤੇ ਜਿਸ ਨੂੰ ਦੇਖਣ ਦਾ ਵੀ ਬਹੁਤ ਆਨੰਦ ਆਉਂਦਾ ਹੈ ਉਹਨਾਂ ਪੱਥਰਾਂ 'ਚ ਵੱਖ ਵੱਖ ਰੰਗ ਭਰੇ ਹੁੰਦੇ ਹਨ